ਨੌ ਲੱਖ ਨੱਬੇ ਹਜ਼ਾਰ ਨੌ ਸੌ ਨੱਬੇ ਸੱਤ ਲੱਖ ਸਤੱਤਰ ਹਜ਼ਾਰ ਪੰਜ ਸੌ ਨੌ ਦੋ ਲੱਖ ਚਾਰ ਹਜ਼ਾਰ ਅੱਠ ਸੌ ਬਾਰ੍ਹਾਂ ਪੰਜ ਲੱਖ ਤੀਹ ਹਜ਼ਾਰ ਨੌ ਸੌ ਨੌ ਲੱਖ ਚਾਰ ਹਜ਼ਾਰ ਦੋ ਸੌ ਇੱਕ